ਟੈਕਨੋਲੋਜੀ ਨੇ ਸਾਡੇ ਮਨੋਰੰਜਨ ਦੇ ਤਰੀਕੇ ਵਿੱਚ ਬਹੁਤ ਵੱਡਾ ਬਦਲਾਅ ਲਿਆਇਆ ਹੈ ਸਭ ਤੋਂ ਪਹਿਲਾਂ ਮੂਵੀਜ਼ ਅਤੇ ਟੀ ਵੀ ਸ਼ੋਜ਼ ਦੇਖਣ ਦਾ ਤਰੀਕਾ ਬਹੁਤ ਬਦਲ ਗਿਆ ਵਾ ਹੁਣ ਸਿਨੇਮਾਂ ਜਾਂ ਕੇਵਲ ਟੀ ਵੀ ਦੀ ਥਾਂ 'ਤੇ ਅਸੀਂ ਨੈਟਫਲਿਕਸ ਐਮਾਜ਼ੋਨ ਪ੍ਰਾਈਮ ਅਤੇ ਡਿਜਨੀ ਪਲੱਸ ਹੋਟ ਸਟਾਰ ਵਰਗੀ ਓ ਟੀ ਟੀ ਪਲੈਟਫਾਰਮਸ

ਦੂਜੇ ਨੰਬਰ 'ਤੇ ਸ਼ੋਸ਼ਲ ਮੀਡੀਆ ਨੇ ਵੀ ਮਨੋਰੰਜਨ ਦੇ ਤਰੀਕੇ ਵਿੱਚ ਨਵਾਂਪਨ ਲਿਆਂਦਾ ਵਾ ਇੰਸਟਾਗਰਾਮ ਰੀਲਜ ਹੋ ਗਏ ਯੂਟੀਊਬ ਸ਼ੋਟਸ ਹੋ ਗਿਆ ਅਤੇ ਟਿਕਟੋਕ ਵਰਗੇ ਪਲੇਟਫਾਰਮ ਲੋਕਾਂ ਨੂੰ ਨਵੇਂ ਅਤੇ ਰਚਨਾਤਮਕ ਵੀਡੀਓਜ ਦੇਖਣ ਅਤੇ ਬਣਾਉਣ ਦਾ ਮੌਕਾ ਦਿੰਦੇ ਹਨ ਇਹ ਹੁਣ ਸਿਰਫ ਮਜੋਰਜ ਮਨੋਰੰਜਨ ਹੀ ਨਹੀਂ ਬਲਕਿ ਕੈ ਕੈਰੀਅਰ ਅਤੇ ਆਮਦਨ ਦਾ ਸਰੋਤ ਵੀ ਬਣ ਰਹੇ ਹਨ ਇਸ ਤੋਂ ਇਲਾਵਾ ਔਨਲਾਈਨ ਗੇਮਿੰਗ ਅਤੇ ਵਰਚੁਅਲ ਰਿਆਲਿਟੀ ਔਗੁਮੈਂਟਡ ਰਿਐਲਿਟੀ ਨੇ ਵੀ ਮਨੋਰੰਜਨ ਨੂੰ ਇੱਕ ਹੋਰ ਅਤੇ ਇੰਟਰੈਕਟਿਵ ਲੈਵਲ 'ਤੇ ਲਿਜਾਇਆ ਹੈ ਲੋਕ ਹੁਣ ਪਬਜੀ ਫੋਟ ਨਾਈਟ ਅਤੇ ਪਲੇ ਸਟੇਸ਼ਨ ਵੀ ਆਰ ਗੇਮਸ ਵਰਗੇ ਗੇਮਸ ਰਾਹੀਂ ਇੱਕ ਨਵੀਂ ਦੁਨਿਆਵੀ ਅਨੁਭਵ ਵਿੱਚ ਸ਼ਾਮਲ ਹੋ ਰਹੇ ਹਨ ਕੁੱਲ ਮਿਲਾ ਕੇ ਟੈਕਨੋਲਜੀ ਨੇ ਸਾਨੂੰ ਮਨੋਰੰਜਨ ਲਈ ਵਧੇਰੇ ਆਜ਼ਾਦੀ ਵਿਆਪਕ ਪਹੁੰਚ ਅਤੇ ਨਵੀਂ ਇੰਟਰੈਕਟਿਵ ਵਿਧੀਆ ਦਿੱਤੀਆਂ ਹਨ ਜੋ ਸਾਨੂੰ ਹਮੇਸ਼ਾ ਨਵਾਂ ਅਤੇ ਉਤਸ਼ਾਹਪੂਰਨ ਅਨੁਭਵ ਪ੍ਰਦਾਨ ਕਰਦੀਆਂ ਹਨ ਅਤੇ ਮੈਂ ਵੀ ਇਹਨਾਂ ਨੂੰ ਬਹੁਤ ਵਰਤਦਾ ਹਾਂ ਅਤੇ ਬਹੁਤ ਹੀ ਪਸੰਦ ਕਰਦਾ ਹਾਂ